ਆਪਣੇ ਸਮਾਜ ਵਿੱਚ ਖੇਡਾਂ ਖੇਡਣ ਦੇ ਮਹੱਤਵ ਬਾਰੇ ਲੋਕਾਂ ਦੀ ਰਾਏ ਬਹੁਤ ਵਧੀਆ ਹੈ ਪਿੰਡਾਂ ਵਿੱਚ ਪੇਂਡੂ ਖੇਡਾਂ ਜਿਵੇਂ ਕਬੱਡੀ ਕੁਸ਼ਤੀ ਫੁੱਟਬਾਲ ਹਾਕੀ ਵਾਲੀਬਾਲ ਖੋ ਖੋ ਕ੍ਰਿਕਟ ਆਦਿ ਖੇਡਾਂ ਖੇਡੀਆਂ ਜਾਂਦੀਆਂ ਹਨ ਖੇਡਾਂ ਖੇਡਣ ਨਾਲ ਸਰੀਰ ਦੀ ਕਸਰਤ ਹੁੰਦੀ ਹੈ ਅਤੇ ਸਾਡਾ ਸਰੀਰ ਤਾਕਤਵਰ ਅਤੇ ਮਜਬੂਤ ਹੁੰਦਾ ਹੈ ਅਤੇ ਖਿਡਾਰੀ ਅਤੇ ਪਿੰਡ ਦੇ ਲੋਕ ਹੋਰ ਕਿਸਮ ਦੇ ਨਸ਼ਿਆਂ ਤੋਂ ਬਚੇ ਰਹਿੰਦੇ ਹਨ ਪਿੰਡਾਂ ਦੇ ਲੋਕਾਂ ਦਾ ਸੁਭਾਅ ਵਿੱਚ ਪ੍ਰੇਮ ਪਿਆਰ ਵੱਧਦਾ ਹੈ ਅਤੇ ਆਪਸੀ ਭਾਈਚਾਰਾ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ ਖੇਡਾਂ ਖੇਡਣ ਨਾਲ ਸਾਡਾ ਮਨੋਰੰਜਨ ਵੀ ਹੁੰਦਾ ਹੈ ਅਤੇ ਦਿਮਾਗੀ ਤਨਾਅ ਵੀ ਦੂਰ ਹੁੰਦਾ ਹੈ ਖੇਡਾਂ ਵਿਚ ਭਾਗ ਲੈ ਕੇ ਅਸੀਂ ਖਿਡਾਰੀ ਬਣ ਕੇ ਦੇਸ਼ ਦਾ ਨਾਂ ਰੋਸ਼ਨ ਕਰ ਸਕਦੇ ਹਾਂ